ਮੇਰਾ ਨਾਮ ਤੇਂਜੰਦਰ ਸਿੰਘ ਹੈ ਮੈਂ ਐੱਮ ਏ ਕਲਾਸ ਵਿੱਚ ਪੜ੍ਹਦਾ ਹਾਂ ਮੇਰੇ ਕਾਲਜ ਦਾ ਨਾਮ ਖਾਲਸਾ ਕਾਲਜ ਪਟਿਆਲਾ ਹੈ ਮੈਨੂੰ ਫੁੱਟਬਾਲ ਦੇ ਮੈਚ ਦੇਖਣੇ ਅਤੇ ਚੈੱਸ ਖੇਡਣੀ ਬਹੁਤ ਹੀ ਪਸੰਦ ਹੈ ਇਸ ਤੋਂ ਇਲਾਵਾ ਮੈਂ ਲਗਾਤਾਰ ਫੋਨ ਉੱਤੇ ਔਨਲਾਈਨ ਮੂਵੀਜ਼ ਵੀ ਦੇਖਦਾਂ ਜਿਸ ਦੇ ਵਿੱਚ ਮੈਨੂੰ ਵੈਬ ਸੀਰੀਜ ਅਤੇ ਐਕਸ਼ਨ ਮੂਵੀਜ਼ ਦੇਖਣਾ ਵੀ ਬਹੁਤ ਪਸੰਦ ਹੈ ਇਸ ਤੋਂ ਇਲਾਵਾ ਇੱਕ ਮੇਰਾ ਸ਼ੌਂਕ ਰੀਡਿੰਗ ਕਰਨ ਦਾ ਹੈ ਮੈਂ ਕਿਤਾਬਾਂ ਪੜ੍ਹਨ ਦਾ ਵੀ ਸ਼ੌਕੀਨ ਹਾਂ ਇਸ ਤੋਂ ਇਲਾਵਾ ਘੋੜ ਸਵਾਰੀ ਅਤੇ ਕਿਤੇ ਦੂਰ ਥਾਵਾਂ ਦੇ ਉੱਤੇ ਪਹਾੜੀ ਏਰੀਆ ਘੁੰਮ ਕੇ ਆਉਣਾ ਵੀ ਮੈਨੂੰ ਚੰਗਾ ਲੱਗਦਾ ਹੈ ਦੋਸਤਾਂ ਦੇ ਨਾਲ ਬੈਠ ਕੇ ਗੱਪਾਂ ਮਾਰਨੀਆਂ ਚਾਹ ਪੀਣੀਆਂ ਵੀ ਮੈਨੂੰ ਪਸੰਦ ਨੇ ਅਤੇ ਵਿਆਹਾਂ ਦੇ ਵਿੱਚ ਜਾਣਾ ਅਤੇ ਚੰਗੇ ਚੰਗੇ ਪਕਵਾਨ ਖਾਣੇ ਇਸ ਦਾ ਵੀ ਮੈਂ ਸ਼ੌਕੀਨ ਹਾਂ